ਸਾਡੇ ਪਿੰਡ ਵਿੱਚ ਸਾਨੂੰ ਖੇਤੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਇਹ ਉਹਨਾਂ ਦੀ ਉਪਜ ਹੈ ਜਿਸ ਨਾਲ ਉਹ ਪੈਸਾ ਕਮਾਉਂਦੇ ਹਨ ਪੈਸਾ ਉਹਨਾਂ ਲਈ ਰੋਜ਼ਾਨਾ ਜੀਵਨ ਜਾਂ ਗੁਜ਼ਾਰਨ ਵਿੱਚ ਕਾਫੀ ਮਹੱਤਵ ਹੈ ਉਂਝ ਖੇਤੀ ਬਹੁਤ ਘੱਟ ਹੁੰਦੀ ਜਾ ਰਹੀ ਹੈ ਜਿਵੇਂ ਜਿਵੇਂ ਲੋਕ ਪੜ੍ਹਾਈ ਪਸੰਦ ਕਰਦੇ ਹਨ ਉਵੇਂ ਉਵੇਂ ਖੇਤੀ ਦੀ ਮਹੱਤਤਾ ਘਟਦੀ ਜਾ ਰਹੀ ਹੈ ਸਾਡੇ ਕਸਬੇ ਵਿੱਚ ਬਹੁਤ ਲੋਕ ਪਰਵਾਸ ਕਰਦੇ ਹਨ ਉਹ ਆਮ ਨੌਕਰੀਆਂ ਜਿਵੇਂ ਬੈਂਕ ਵਿੱਚ ਕੰਮ ਕਰਨਾ ਔਫਿਸਸ 'ਚ ਕੰਮ ਕਰਨਾ ਕਿਸੇ ਦੁਕਾਨ ਉੱਤੇ ਕੰਮ ਕਰਨਾ ਬਹੁਤ ਸਾਰੇ ਕੰਮ ਹਨ ਜੋ ਕੀਤੇ ਜਾਂਦੇ ਹਨ ਪਰ ਖੇਤੀ ਨੂੰ ਉਹ ਭੁੱਲ ਚੁੱਕੇ ਹਨ ਕੋ ਅੱਜ ਦੇ ਨੌਜਵਾਨ ਖੇਤੀ ਨੂੰ ਪਸੰਦ ਨਹੀਂ ਕਰਦੇ